ਲੰਬੀ ਬਾਈਕਿੰਗ ਯਾਤਰਾ ਜਾਂ ਟੂਰ ਲਈ ਸਾਨੂੰ ਆਪਣੇ ਨਾਲ ਸਾਰਾ ਸਮਾਨ ਕੈਰੀ ਕਰਕੇ ਲੈ ਕੇ ਜਾਣਾ ਚਾਹੀਦਾ ਹੈ ਸਭ ਤੋਂ ਪਹਿਲਾਂ ਸਾਨੂੰ ਆਪਣੇ ਨਾਲ ਟੂਲ ਕਿੱਟ ਫਸਟਡ ਬੋਕਸ ਹੈਲਮੇਟ ਇਹ ਤਿੰਨ ਅਜਿਹੀ ਚੀਜ਼ਾਂ ਹਨ ਜੋ ਬਹੁਤ ਜ਼ਿਆਦਾ ਮਹੱਤਵਪੂਰਨ ਹਨ ਇਹ ਸਾਰਿਆਂ ਨਾਲੋਂ ਪਹਿਲਾਂ ਸਾਨੂੰ ਆਪਣੇ ਨਾਲ ਕੈਰੀ ਕਰਕੇ ਲੈ ਕੇ ਜਾਣੀ ਚਾਹੀਦੀ ਹੈ